ਹੈਲੋ ਹਾਂਜੀ ਕੌਣ ਦਿਵਜੋਤ ਕੌਰ ਜੀ ਬੋਲਦੇ ਓ ਮੈਂ ਨਾ ਕੈਨੇਡਾ ਤੋਂ ਬੋਲਦੀ ਹਾਂ ਮੈਨੂੰ ਮੇਰੀ ਫਰੈਂਡ ਹੈ ਇੱਕ ਉਹਨਾਂ ਨੇ ਨੰਬਰ ਦਿੱਤਾ ਸੀ ਤੁਹਾਡਾ ਅਤੇ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ ਦੋ ਮਿੰਟ ਹਾਂ ਮੈਂ ਨਾ ਇੱਥੇ ਪੰਜਾਬ ਆਉਣਾ ਚਾਹੁੰਦੀ ਹਾਂ ਅਤੇ ਇੱਥੇ ਮੈਂ ਸੋਚਿਆ ਵੀ ਪਹਿਲਾਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਕੇ ਵੀ ਫਿਰ ਮੈਂ ਆਪਣੇ ਕੰਮਕਾਰ ਕਰਾਂ ਬਾਕੀ ਦੇ ਅਤੇ ਮੈਂ ਪੁੱਛਣਾ ਚਾਹੁੰਦੀ ਸੀ ਵੀ ਇੱਥੋਂ ਦਾ ਮੌਸਮ ਕਿੱਦਾਂ ਦਾ ਵੀ ਮੈਨੂੰ ਕਦੋਂ ਆਉਣਾ ਚਾਹੀਦਾ ਇਹਦੇ ਬਾਰੇ ਦੱਸੋਂਗੇ ਮੈਂ ਸੋਚਿਆ ਵੀ ਅਗਲੇ ਮਹੀਨੇ ਹੀ ਆਵਾਂ ਦਸੰਬਰ ਦਾ ਮਹੀਨੇ ਆਵਾ ਅਤੇ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ

ਅੱਛਾ ਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਅੱਛਾ ਜੀ ਠੀਕ ਹੈ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਅਤੇ ਇੱਥੇ ਨਾ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਜੇ ਥੋੜ੍ਹੇ ਕੁ ਦਿਨ ਰੁਕਣਾ ਹੋਵੇ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਅਤੇ ਇੱਥੇ ਨਾ ਹੋਰ ਵੀ ਹੈਗੀਆਂ ਦੇਖਣ ਵਾਲੀਆਂ ਜਗ੍ਹਾ ਫਤਿਹਗੜ੍ਹ ਸਾਹਿਬ ਅੱਛਾ ਜੀ ਅੱਛਾ ਜੀ ਠੀਕ ਹੈ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਅੱਛਾ ਜੀ ਠੀਕ ਹੈ ਹਾਂਜੀ ਹਾਂ ਹਾਂ ਨਹੀ ਮੈਂ ਕਾਫੀ ਸਾਲਾਂ ਤੋਂ ਸੋਚ ਰਹੀ ਸੀ ਵੀ ਮੈਂ ਜਾ ਕੇ ਆਵਾਂ ਦਰਸ਼ਨ ਕਰਕੇ ਆਵਾਂ ਚਲੋ ਠੀਕ ਹੈ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਓਕੇ